ਸਤਿ ਸ਼੍ਰੀ ਅਕਾਲ ਸਰ ਮੈਂ ਆਪਣੇ ਘਰ ਵਿੱਚ ਪਿਛਲੇ ਛੇ ਮਹੀਨਿਆਂ ਤੋਂ ਤੁਹਾਡੇ ਦੁਆਰਾ ਆਪਣੇ ਘਰ ਵਿੱਚ ਲੈਂਡਲਾਈਨ ਇੰਟਰਨੈਟ ਕਨੈਕਸ਼ਨ ਲਗਵਾਇਆ ਹੈ ਜੋ ਕਿ ਸਹੀ ਚੱਲ ਰਿਹਾ ਸੀ ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਇੰਟਰਨੈਟ ਹੌਲੀ ਚੱਲ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਇਸ ਦਾ ਛੇ ਮਹੀਨੇ ਦਾ ਜੋ ਬਿੱਲ ਲਗਵਾਉਣ ਵੇਲੇ ਦਿੱਤਾ ਸੀ ਉਹ ਛੇ ਮਹੀਨੇ ਪੂਰੇ ਹੋਣ ਵਾਲੇ ਹੈ ਜਿਸ ਕਾਰਨ ਘਰ ਵਿੱਚ ਇੰਟਰਨੈਟ ਦੀ ਸਪੀਡ ਬਹੁਤ ਹੀ ਹੌਲੀ ਚੱਲ ਰਹੀ ਹੈ ਕਿਰਪਿਆ ਕਰਕੇ ਮੈਨੂੰ ਇਹ ਦੱਸੋ ਕਿ ਲੈਂਡਲਾਈਨ ਇੰਟਰਨੈਟ ਦਾ ਬਿੱਲ ਫਿਰ ਤਾਂ ਦੇਣ ਵਾਲਾ ਨਹੀਂ ਜੇ ਬਿੱਲ ਉਤਾਰਨ ਵਾਲਾ ਹੈ ਤਾਂ ਮੈਂ ਬਿੱਲ ਦੇ ਦਿੰਦਾ ਹਾਂ ਜੋ ਕਿ ਇੰਟਰਨੈਟ ਸੇਵਾ ਵਿੱਚ ਕੋਈ ਰੁਕਾਵਟ ਨਾ ਆ ਸਕੇ